ਹੈਲੋ ਹਾਂਜੀ ਹਾਂਜੀ ਸਾਨੂੰ ਹਾਂਜੀ ਸਾਨੂੰ ਬੰਦਿਆਂ ਦੀ ਲੋੜ ਆ ਜੀ ਹਾਂਜੀ ਤੁਸੀਂ ਕਿੰਨਾ ਪੜ੍ਹੇ ਹੋ ਕਿੱਥੋਂ ਪੜੇ ਓ ਜੀ ਅੱਛਾ ਜੀ ਕੋਈ ਕਿਤੇ ਕੰਮ ਕੀਤਾ ਤੁਸੀਂ ਕਿੱਥੇ ਜੀ ਅੱਛਾ ਜੀ ਤੇ ਚਲੋ ਕਿੰਨਾ ਚਿਰ ਕੀਤਾ ਜੀ ਅੱਛਾ ਜੀ ਤੇ ਹੁਣ ਤੁਸ ਕਿੱਥੇ ਕਿੱਥੇ ਕਿੱਥੇ ਕੀਤਾ ਹਾਂਜੀ ਠੀਕ ਕਿੰਨੇ ਸਾਲ ਹੋ ਗਏ ਜੀ ਕੰਮ ਕੀਤੇ ਨੂੰ ਠੀਕ ਆ ਜੀ ਕੀ ਕੀ ਕੰਮ ਕੀਤਾ ਤੁਸੀਂ ਕੀ ਕੰਮ ਕੀਤਾ ਅੱਛਾ ਕਿੰਨੀ ਤਨਖਾਹ ਜੀ ਚਾਹੀਦੀ ਆ ਤੁਹਾਨੂੰ ਅਸੀਂ ਜੀ ਸੱਤ ਕ ਹਜਾਰ ਦੇ ਸਕਦੇ ਆਂ

ਹਾਂ ਤੁਸੀਂ ਹਾਂ ਕੋਈ ਨਾ ਤੁਸੀਂ ਸੋਮਵਾਰ ਨੂੰ ਫੋਨ ਕਰਕੇ ਆ ਜਾਓ ਜੀ ਤੇ ਫਿਰ ਦੇਖ ਲੈਦੇ ਆ ਕੰਮ ਦੇਖ ਕੇ ਹਾਂ ਫੋਨ ਕਰਕੇ ਆਇਓ ਜੀ ਦ ਦਸ ਕੁ ਵਜੇ ਆ ਜਿਓ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਸਰਟੀਫਿਕੇਟ ਰਿਜਰਵ ਕੋਈ ਸਰਟੀਫਿਕੇਟ ਸਿਆਓ ਜੇ ਕੋਈ ਤਜਰਬੇ ਆਲਾ ਹੋਵੇ ਉਹ ਵੀ ਲੈ ਆਓ ਜੇ ਪੜਾਈ ਵਾਲਾ ਵੀ ਲੈ ਆਇਓ ਜੀ ਹਾਂਜੀ ਹਾਂ ਆਧਾਰ ਕਾਰਡ ਵਗੈਰਾ ਵੀ ਲੈ ਆਇਓ ਹੋ ਫੋਟੋਆਂ ਲੈ ਆਇਓ ਹਾਂਜੀ ਹਾਂ ਹਾਂਜੀ ਹਾਂਜੀ ਵੋਟਰ ਕਾਰਡ ਵੀ ਲੈ ਆਇਓ ਜੇ ਹੈਗਾ ਤਾਂ ਹਾਂਜੀ ਠੀਕ ਹੈ ਜੀ